ਹਾਂਜੀ ਮੈਂ ਬਚਪਨ ਤੋਂ ਹੀ ਸਿਲਾਈ ਕਢਾਈ ਦਾ ਸ਼ੌਕ ਰੱਖਦੀ ਹਾਂ ਅਤੇ ਮੈਂ ਸਿਲਾਈ ਕਢਾਈ ਆਪ ਵੀ ਕਰਦੀ ਹਾਂ ਅਤੇ ਮੇਰੇ ਘਰ 'ਚ ਮੇਰੀ ਨੂੰਹ ਵੀ ਕਰਦੀ ਹੈ ਅਤੇ ਉਸ ਨੂੰ ਵੀ ਬਹੁਤ ਸ਼ੌਕ ਹੈ ਮੈਂ ਸਲਵਾਰ ਸੂਟ ਕੁੜਤੇ ਪਜਾਮੇ ਆਦਿ ਸੀਂਦੀ ਹਾਂ ਸਾਡੇ ਇਲਾਕੇ ਵਿੱਚ ਆਦਮੀ ਵੀ ਕਾਫੀ ਸਿਲਾਈ ਕਰਦੇ ਹਨ ਪਰ ਮੇਰੀ ਮੇਰਾ ਕੰਮ ਸਭ ਤੋਂ ਅੱਛਾ ਅਤੇ ਬਹੁਤ ਵਧੀਆ ਹੁੰਦਾ ਹੈ ਇਸ ਕਰਕੇ ਮੇਰਾ ਕੰਮ ਕਾਫੀ ਚੱਲਦਾ ਹੈ ਅਤੇ ਕੋਈ ਵੀ ਉਲਾਹਮਾ ਨਹੀਂ ਆਉਂਦਾ ਮੇਰੀ ਨੂੰਹ ਵੀ ਮੇਰਾ ਬੜਾ ਸਾਥ ਦਿੰਦੀ ਹੈ ਇਸ ਕੰਮ ਵਿੱਚ ਅਸੀਂ ਕਾਫੀ ਤਰ੍ਹਾਂ ਦੇ ਡਿਜ਼ਾਇਨ ਵੀ ਬਣਾਈ ਦੇ ਹਨ ਔਰ ਡਿਜ਼ਾਇਨ ਲੋਕਾਂ ਨੂੰ ਕਾਫੀ ਪਸੰਦ ਆਏ ਆਉਂਦੇ ਹਨ ਅਸੀਂ ਕਢਾਈ ਵੀ ਕਰਦੇ ਹਾਂ ਜਿੱਦਾਂ ਪੱਖੀਆਂ ਕਢਾਈ ਦੀਆਂ ਬਣਾਉਂਦੇ ਹਾਂ ਗਰਮੀਆਂ ਵਿੱਚ ਉਹਨਾਂ ਕਢਾਈ ਵਾਲੀਆਂ ਪੱਖੀਆਂ ਕਾਫੀ ਲੋਕ ਲੈਂਦੇ ਹਨ ਅਤੇ ਇਸ ਵਰਤਦੇ ਹਨ ਗਰਮੀ ਵਿੱਚ ਜਦੋਂ ਲਾਈਟ ਚਲ ਜਾਂਦੀ ਅਤੇ ਉਹ ਪੱਖੀਆਂ ਕਢਾਈ ਵਾਲੀਆਂ ਬਹੁਤ ਅੱਛੀਆਂ ਲੱਗਦੀਆਂ ਹਨ ਬਹੁਤ ਸੁੰਦਰ ਲੱਗਦੀਆਂ ਹਨ ਅਤੇ